ਹੈਲੋ ਹੈਲੋ ਹਾਂ ਸਤਿ ਸ਼੍ਰੀ ਕਾਲ ਤੁਸੀਂ ਮੈਮ ਨੀਸ਼ਾ ਮੈਮ ਬੋਲਦੇ ਹੋ ਅੱਛਾ ਜੀ ਮੈਮ ਮੈਂ ਨਾ ਤੁਹਾਨੂੰ ਇੱਕ ਦਿੱਕਤ ਬਾਰੇ ਦੱਸਣਾ ਸੀਗਾ ਪਲੀਜ਼ ਵੀ ਮੈਨੂੰ ਨਾ ਦਿੱਕਤ ਹੈ ਹਾਂਜੀ ਕੰਨ ਦੀ ਪ੍ਰੋਬਲਮ ਹੈ ਮੈਨੂੰ ਨਾ ਆਈ ਵਿੰਟਰ ਜਦੋਂ ਵੀ ਮਤਲਬ ਸਰਦੀਆਂ ਆਉਂਦੀਆਂ ਆ ਮੈਨੂੰ ਜੁਖਾਮ ਹੋ ਜਾਂਦਾ ਆ ਤਾਂ ਮੇਰਾ ਕੰਨ ਹੈ ਨਾ ਉਹ ਬਲੋਕ ਹੋ ਜਾਂਦਾ ਆਪਣੇ ਆਪ ਜੁਖਾਮ ਕਰਕੇ ਹਾਂਜੀ

ਹਾਂਜੀ ਤੁਹਾਨੂੰ ਮੈਂ ਦੱਸਦੀ ਹਾਂ ਵੀ ਮੈਨੂੰ ਦਿੱਕਤ ਕੀ ਹੈ ਵੀ ਜਦੋਂ ਵੀ ਮੈਂ ਮੈਨੂੰ ਜੁਖਾਮ ਹੁੰਦਾ ਨਾ ਔਟੋਮੈਟਿਕਲੀ ਮੇਰਾ ਕੰਨ ਹੈ ਜਿਹੜਾ ਬੰਦ ਹੋ ਜਾਂਦਾ ਹੈ ਮੈਨੂੰ ਰੇਸ਼ਾ ਏ ਜਿਹੜੀ ਪਰਦੀਆਂ ਪਿੱਛੇ ਜਮ ਜਾਂਦੀ ਹੈ ਅਤੇ ਮੈਂ ਹਰ ਵਾਰੀ ਜਿੱਦਾਂ ਵਿੰਟਰਸ 'ਚ ਦਵਾਈ ਲੈਂਦੀ ਆ ਬਟ ਮੈਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਕਰਕੇ ਮੈਂ ਤੁਹਾਨੂੰ ਕੋਲ ਕਰੀ ਹੈ ਵੀ ਤੁਹਾਡੇ ਬਾਰੇ ਕਿਸੇ ਨੂੰ ਪਤਾ ਕਰਾਇਆ ਸੀ ਸੁਣਿਆ ਸੀਗਾ ਵੀ ਹਾਂਜੀ ਨੀਸ਼ਾ ਮੈਮ ਵਧੀਆ ਦਵਾਈ ਦਿੰਦੇ ਆ ਅਤੇ ਦੇਖਦੇ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਅਤੇ ਮੈਮ ਕਦੋਂ ਵਿਜਿਟ ਕਰਾਂ ਮੈਂ ਫਿਰ ਇਹ ਵੀ ਦੱਸ ਦਿਓ ਮੈਨੂੰ ਕਿਹੜੇ ਟਾਈਮ ਮੈਮ ਓਕੇ ਠੀਕ ਹੈ ਮੈਮ ਕੋਈ ਇਦਾਂ ਮੈਨੂੰ ਦਿੱਕਤ ਤਾਂ ਨਹੀਂ ਆਉਗੀ ਅਗਰ ਮੈਂ ਦਵਾਈ ਲਵਾਂ ਇਸ ਤੋਂ ਬਾਅਦ ਹਾਂਜੀ ਠੀਕ ਹੈ ਫਿਰ ਮੈਂ ਤੁਹਾਡੇ 'ਤੇ ਭਰੋਸਾ ਕਰ ਰਹੀ ਹਾਂ ਤਾਂ ਮੈਂ ਫਿਰ ਕੱਲ ਨੂੰ ਵਿਜਿਟ ਕਰਲੂੰਗੀ ਹਾਂਜੀ ਠੀਕ ਹੈ ਥੈਂਕ ਯੂ ਮੈਮ